ਜੇਕਰ ਇਲਾਕੇ ਨੂੰ ਸਾਫ ਰੱਖਣ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਕੂੜੇ ਦੀ ਜਿਹੜੀ ਸਮੱਸਿਆ ਉਹਨੂੰ ਦੂਰ ਕੀਤੀ ਜਾਵੇ ਮਤਲਬ ਕਿ ਕੂੜੇ ਦਾ ਸਹੀ ਤਰੀਕੇ ਨਾਲ ਕੀ ਕਹਿੰਦੇ ਹੈ ਡਿਸਪੋਜ਼ਲ ਕਰਨਾ ਜਿਵੇਂ ਕਿ ਗਿੱਲਾ ਕੂੜਾ ਸੁੱਕਾ ਕੂੜਾ ਅੱਡ ਅੱਡ ਰੱਖਣਾ ਅਤੇ ਮੈਨੂੰ ਲੱਗਦਾ ਵੀ ਸਿ ਸਿਰਫ ਸਾਡੀ ਨਹੀਂ ਇਹ ਕਰਮਚਾਰੀਆਂ ਦੀ ਵੀ ਜੀ ਵੀ ਜ਼ਿੰਮੇਵਾਰੀ ਹੈ ਜੇ ਅਸੀਂ ਉਹਨਾਂ ਨੂੰ ਕੂੜਾ ਅੱਡ ਅੱਡ ਕਰਕੇ ਦੇ ਰਹੇ ਹਾਂ ਤਾਂ ਉਸ ਨੂੰ ਉਸ ਤਰੀਕੇ ਨਾਲ ਹੀ ਅੱਗੇ ਪਹੁੰਚਾਉਣ ਕਈ ਵਾਰ ਇਵੇਂ ਹੁੰਦਾ ਕਿ ਅਸੀਂ ਜਾਂ ਤਾਂ ਕੂੜਾ ਅਲੱਗ ਅਲੱਗ ਨਹੀਂ ਕਰਦੇ ਅਤੇ ਫਿਰ ਉਹਨਾਂ ਨੂੰ ਆਪ ਅਲੱਗ ਅਲੱਗ ਕਰਨਾ ਪੈਂਦਾ ਹੈ ਕਦੇ ਕਦੇ ਹੁੰਦਾ ਵੀ ਅਸੀਂ ਕਰਕੇ ਦਿੰਦੇ ਹਾਂ ਤਾਂ ਫਿਰ ਉਹ ਆਪ ਹੀ ਇਕੱਠਾ ਕਰ ਦਿੰਦੇ ਨੇ ਤਾਂ ਮੈਨੂੰ ਲੱਗਦਾ ਇਹ ਹੈਗਾ ਜਿਸ ਦੇ ਨਾਲ ਸਾਫ ਸਫਾਈ ਰੱਖਣ ਵਿੱਚ ਮਦਦ ਮਿਲ ਸਕਦੀ ਹੈ ਉਸ ਤੋਂ ਇਲਾਵਾ ਫਰਨੈਲ ਵਗੈਰਾ ਦਾ ਪਾਣੀ ਜਿਹੜਾ ਹੈ ਉਹ ਸੂਟ ਦੇਣਾ ਘਰ ਦੇ ਆਲੇ ਦੁਆਲੇ ਸਵੇਰੇ ਜਾਂ ਸ਼ਾਮ ਨੂੰ ਉਹਦੇ ਨਾਲ ਮੱਛਰ ਵਗੈਰਾ ਨਹੀਂ ਆਉਂਦੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਬਚ ਜਾਂਦੀਆਂ ਅਤੇ ਹਾਂ ਬਸ ਉਸ ਤੋਂ ਇਲਾਵਾ ਬਹੁਤਾ ਜਿਹੜਾ ਕਹਿੰਦੇ ਨੇ ਕੂੜਾ ਨਾ ਪਾਉਣਾ ਆਪਣੇ ਜਿਹੜੀਆਂ ਸੜਕਾਂ ਨੇ ਉਹਨਾਂ ਨੂੰ ਆਪਣੇ ਘਰ ਦੇ ਵਾਂਗ ਹੀ ਸਮਝਣਾ ਕਿਉਂਕਿ ਜਦ ਤੱਕ ਅਸੀਂ ਕਿਸੇ ਚੀਜ਼ ਨੂੰ ਜਾਂ ਕਿਸੇ ਜਗ੍ਹਾ ਨੂੰ ਆਪਣਾ ਨਹੀਂ ਸਮਝਦੇ ਮੈਨੂੰ ਨਹੀਂ ਲੱਗਦਾ ਅਸੀਂ ਉਹਨੂੰ ਸਾਫ ਰੱਖਦੇ ਹਾਂ ਅਤੇ ਬਹੁਤ ਸਾਰੇ ਲੋਕ ਕੀ ਕਰਦੇ ਨੇ ਵੀ ਆਪਣੀਆਂ ਗੱਡੀਆਂ ਸਾਫ ਰੱਖਦੇ ਨੇ ਅਤੇ ਕਚਰਾ ਬਾਹਰ ਸੁੱਟ ਦਿੰਦੇ ਨੇ ਸੜਕਾਂ 'ਤੇ ਅਤੇ ਉਹੀ ਉਹੀ ਘਰਾਂ ਨਾਲ ਕਰਦੇ ਨੇ ਵੀ ਘਰ ਸਾਫ ਕਰਕੇ ਅਤੇ ਬਾਹਰ ਗਲੀਆਂ 'ਚ ਗੰਦ ਸੁੱਟ ਦਿੰਦੇ ਨੇ ਤਾਂ ਮੇਰਾ ਕਹਿਣਾ ਵੀ ਆਪਣੀਆਂ ਗਲੀਆਂ ਆਲੇ ਦੁਆਲੇ ਅਤੇ ਹਰ ਚੀਜ਼ ਨੂੰ ਆਪਣਾ ਹੀ ਸਮਝੀਏ ਅਤੇ ਉਸਨੂੰ ਸਾਫ ਰੱਖੀਏ ਕੂੜਾ ਡਸਟਬਿਨ ਵਿੱਚ ਪਾਈਏ